ਪੰਜਾਬ ਦੇ ਮੁੱਖ ਕੁਦਰਤੀ ਸਰੋਤਰ ਹਨ ਜਿਵੇਂ ਖੇਤੀਬਾੜੀ ਜੋ ਕਿ ਭਾਰਤ ਵਿੱਚ ਜ਼ਿਆਦਾਤਰ ਖੇਤੀ ਅਨਾਜ ਕਿੱਥੇ ਉੱਗ ਰਿਹਾ ਪੰਜਾਬ ਦੇ ਲੋਕ ਹੀ ਉਗਾ ਕੇ ਬਾਹਰ ਪ੍ਰਾਂਤਾਂ ਨੂੰ ਸਪਲਾਈ ਕਰ ਰਹੇ ਹਨ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਬਿਜਲੀ ਵੀ ਬਿਜਲੀ ਪਲਾਂਟ ਹੈ ਰੋਪੜ ਦੇ ਵਿੱਚ ਔਰ ਬਿਜਲੀ ਵੀ ਸਾਡੇ ਪੰਜਾਬ 'ਚੋਂ ਕਾਫੀ ਰਾਜਿਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ ਬਾਕੀ ਮੁੱਖ ਸਰੋਤਰ ਤਾਂ ਇਹੀ ਹੈ ਬਾਕੀ ਪੰਜਾਬ ਦੇ ਵਿੱਚ ਲੋਕ ਆ ਤੇਲ ਗੈਸ ਪਾਣੀ ਇਹਦਾ ਕਾਫੀ ਸ਼ੋਸ਼ਣ ਕਰ ਰਹੇ ਆ ਜੇ ਪਾਣੀ ਵੱਗਦਾ ਤਾਂ ਵੱਗੀ ਜਾ ਰਿਹਾ ਹੈ ਲੋਕਾਂ ਨੂੰ ਇਹ ਨਹੀਂ ਹੈ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਪਾਣੀ ਦੀ ਤੰਗੀ ਆ ਸਕਦੀ ਹੈ ਅਸੀਂ ਪਾਣੀ ਨੂੰ ਬਚਾ ਕੇ ਰੱਖੀਏ ਜਿੰਨੀ ਜ਼ਰੂਰਤ ਹੈ ਅਸੀਂ ਓਨਾਂ ਹੀ ਪਾਣੀ ਚਲਾਈਏ ਉਸ ਤੋਂ ਬਾਅਦ ਅਸੀਂ ਬੰਦ ਕਰ ਦਈਏ ਲੇਕਿਨ ਅਸੀਂ ਕਈ ਥਾਵਾਂ 'ਤੇ ਕਈ ਥਾਵਾਂ 'ਤੇ ਕੀ ਸਮੇਤ ਆਪਣੇ ਘਰ ਦੇ ਵਿੱਚ ਵੀ ਕਦੇ ਕਦੇ ਇੱਦਾਂ ਹੁੰਦਾ ਹੈ ਕਿ ਪਾਣੀ ਚੱਲਦਾ ਤਾਂ ਚੱਲੀ ਜਾ ਰਿਹਾ ਹੈ ਜਿਸ ਨੂੰ ਸਾਨੂੰ ਕਿ ਉਸ ਵੇਲੇ ਉਸਦੀ ਰੋਕਥਾਮ ਕਰਨੀ ਚਾਹੀਦੀ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੇ ਤੁਹਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਪਾਣੀ ਬਿਜਲੀ ਦੀ ਬੜਾ ਹੀ ਮਿਸਯੂਜ ਹੁੰਦਾ ਹੈ ਬਿਜਲੀ ਦਾ ਵੈ ਜੇ ਪੰਜਾਬ ਵਿੱਚ ਬਿਜਲੀ ਫਰੀ ਕਰ ਦਿੱਤੀ ਗਈ ਹੈ ਅਤੇ ਲੋਕ ਜੇ ਚਲਾਉਂਦੇ ਆ ਤਾਂ ਚਲਾਈ ਜਾਂਦੇ ਏਸੀ ਚੱਲਦਾ ਤਾਂ ਚੱਲੀ ਜਾ ਰਿਹਾ ਹੈ ਪੱਖਾ ਚੱਲਦਾ ਤਾਂ ਚੱਲੀ ਜਾ ਰਿਹਾ ਪਾਣੀ ਵਾਲੀ ਮੋਟਰ ਚਲਦੀ ਹੈ ਤਾਂ ਚੱਲੀ ਜਾ ਰਹੀ ਹੈ ਸੋ ਇਸ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਆਪਣੇ ਇਹ ਕੁਦਰਤੀ ਸਰੋਤਰਾਂ ਦਾ ਥੋੜ੍ਹਾ ਸਾਵਧਾਨੀ ਨਾਲ ਯੂਜ ਕਰਨਾ ਚਾਹੀਦਾ ਇਹਨੂੰ ਸੰਭਾਲ ਕੇ ਯੂਜ ਕਰਨਾ ਚਾਹੀਦਾ ਕਿਉਂਕਿ ਕਹਿ ਰਹੇ ਆ ਕਿ ਆਉਣ ਵਾਲੇ ਟਾਈਮ ਵਿੱਚ ਪਾਣੀ ਇੰਨਾਂ ਕੁ ਧਰਤੀ ਦੇ ਥੱਲੇ ਜਾ ਜਾਏਗਾ ਕਿ ਸਾਡੇ ਬੱਚੇ ਆਉਣ ਵਾਲੀ ਸਾਡੀਆਂ ਜਨਰੇਸ਼ਨਾਂ ਪਾਣੀ ਪੀਣ ਤੋਂ ਵੀ ਤਰਸਣਗੀਆਂ ਸੋ ਸਾਨੂੰ ਇਹ ਚਾਹੀਦਾ ਕਿ ਸਾਨੂੰ ਕੁਦਰਤੀ ਸਰੋਤਰਾਂ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਬਾਕੀ ਸਾਡੇ ਪੰਜਾਬ ਦਾ ਮੁੱਖ ਕੁਦਰਤੀ ਸਰੋਤਰ ਖੇਤੀ ਹੀ ਹੈ ਜਿਸ ਨਾਲ ਸਾਡੇ ਦੇਸ਼ ਵਿੱਚ ਅਨਾਜ ਆ ਰਿਹਾ ਹੈ ਔਰ ਸਾਡੇ ਕਈ ਭੁੱਖੇ ਲੋਕਾਂ ਦੇ ਢਿੱਡ ਭਰ ਰਹੇ ਹਨ ਪੰਜਾਬ ਦੇ ਖਾਤਿਰ